ਹੈਲੋ ਹਾਂਜੀ ਟੀ ਸ਼ੋਪ ਵਾਲੇ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਜੀ ਮੈਂ ਕੁਛ ਆਰਡਰ ਕਰਵਾਉਣਾ ਸੀ ਥੋੜ੍ਹਾ ਮੇਨੂ ਅਤੇ ਉਹਦੇ ਬਾਰੇ ਕਿਊਰੀ ਸੀਗੀ ਵੀ ਤਾਂ ਆਪਣੇ ਕੋਲ ਕਿਹੜੇ ਕਿਹੜੇ ਚਾਹ ਹੁੰਦੀ ਆ ਠੀਕ ਹੈ ਅਤੇ ਜਿਵੇਂ ਹੁਣ ਮੇਰੇ ਮੇਰੇ ਘਰ ਕਿੱਟੀ ਪਾਰਟੀ ਹੈਗੀ ਆ ਕਿੱਟੀ ਪਾਰਟੀ ਰਖਵਾਈ ਆ ਤਾਂ ਫਿਰ ਜਿਵੇਂ ਪੰਜਾਹ ਕੁ ਗੈਸਟ ਅਤੇ ਜਾਂ ਵੀਹ ਤੀਹ ਗੈਸਟ ਇੰਨੇ ਕੁ ਜਾਣਿਆ ਵਾਸਤੇ ਤੁਸੀਂ ਕਰ ਸਕਦੇ ਹੋ

ਹਾਂਜੀ ਠੀਕ ਹੈ ਅਤੇ ਨਾਲ ਜਿਵੇਂ ਤੁਸੀਂ ਕਟਲੇਰੀ ਵਗੈਰਾ ਤੁਸੀਂ ਦਿੰਦੇ ਹੋ ਕਿ ਮਤਲਬ ਕਹਿੰਦੇ ਉਹ ਆਪਦੀਆਂ ਆਪਦੀ ਹੁੰਦੀ ਹੈ

ਠੀਕ ਹੈ ਠੀਕ ਹੈ ਅਤੇ ਹੋਰ ਤੁਸੀਂ ਹਾਂਜੀ ਠੀਕ ਠੀਕ ਹੈ ਠੀਕ ਹੈ ਅਤੇ ਆਪਣੇ ਜਿਹੜੇ ਬੇਕਰੀ ਦੇ ਬਿਸਕੁਟ ਹੁੰਦੇ ਆ ਕਿ ਵੀ ਜਿਹੜੇ ਦੂਸਰੇ ਹੁੰਦੇ ਆ ਮੈਦੇ ਵਾਲੇ ਹਮ ਅਤੇ ਬੇਕਰੀ ਵੀ ਹਾਂਜੀ ਨਹੀਂ ਦੇਖਣਾ

ਠੀਕ ਹੈ ਠੀਕ ਹੈ ਅਤੇ ਵੀ ਜਿਵੇਂ ਜੇ ਹੁਣ ਬਰਾਉਨ ਸ਼ੂਗਰ ਵਾਲਾ ਚਾਹੀਦਾ ਹੋਵੇ ਤਾਂ ਉਹ ਤੁਹਾਡੇ ਕੋਲ ਹੋਏਗਾ ਕਿ ਵੀ ਗੁੜ ਗੁੜ ਵਾਲੇ ਹੋਣਗੇ ਤੁਹਾਡੇ ਕੋਲ ਠੀਕ ਹੈ ਠੀਕ ਹੈ ਅਤੇ ਬਾਕੀ ਜਿਵੇਂ ਹੋਰ ਵਰਾਇਟੀਜ਼ ਨਾਲ ਕਿਵੇਂ ਤੁਸੀਂ ਕੀ ਕੀ ਕਹਿੰਦੇ ਸੀ ਸਮੋਸੇ ਹੋ ਗਏ ਜਾਂ ਫਿਰ ਪੈਟਿਜ਼ ਹੋ ਗਈਆਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਅਤੇ ਉਸਦੇ ਨਾਲ ਮਤਲਬ ਕਿ ਵੀ ਆਪਣਾ ਖਰਚਾ ਕਿੰਨਾ ਹੋ ਗਿਆ ਜਿਵੇਂ ਮੇਰੇ ਮੇਰੇ ਹਿਸਾਬ ਨਾਲ ਜਿਹੜੀ ਕਿ ਇੱਕ ਪਲੇਟ ਸੱਠ ਰੁਪਏ ਵੱਧ ਤੋਂ ਵੱਧ ਹੋਣੀ ਚਾਹੀਦੀ ਜਾਂ ਫਿਰ ਆਪਾਂ ਸੱਤਰ ਲਗਾ ਸਕਦੇ ਹਾਂ ਵੀ ਉਨੇ ਕੁ ਬਜਟ ਵਿੱਚ ਵੀ ਮੈਂ ਆਪਦੀ ਕਿੱਟੀ ਪਾਰਟੀ ਜਿਹੜੀ ਕਿ ਉਹ ਕਰਨੀ ਆ ਅਤੇ ਜਿਹੜੇ ਬੰਦੇ ਹੈਗੇ ਆ ਉਹ ਮੇਰੇ ਕੋਲ ਆਉਣੇ ਹੈ ਚਾਲ੍ਹੀ ਚਾਲ੍ਹੀ ਬੰਦਿਆਂ ਨੇ ਆਉਣਾ ਅਤੇ ਇੱਕ ਪਲੇਟ ਸੱਠ ਰੁਪਏ ਦੀ ਹੋਣੀ ਚਾਹੀਦੀ ਹੈ ਵੀ ਉਹਦੇ ਹਿਸਾਬ ਨਾਲ ਹੀ ਫਿਰ ਮੈਂ ਕਰਨਾ ਫਾਈਨਲਾਈਜ਼ ਅਤੇ ਫਿਰ ਮੈਨੂੰ ਰੇਟਸ ਵੀ ਤੁਸੀਂ ਦੱਸ ਦਿਉ ਵੀ ਜਿਵੇਂ ਇੱਕ ਵੜਾ ਪਾਓ ਦਾ ਤੁਸੀਂ ਕਿੰਨਾ ਕਿੰਨਾ ਕਰੋਗੇ ਹਾਂਜੀ ਚਾਲ੍ਹੀ ਦਾ ਤਾਂ ਫਿਰ ਨਹੀਂ ਚਾਲ੍ਹੀ ਦਾ ਤਾਂ ਦੇਖੋ ਜੀ ਮਹਿੰਗਾ ਹੋ ਜਾਏਗਾ ਕਿਉਂਕਿ ਫਿਰ ਸੱਠ 'ਤੇ ਤਾਂ ਜੇ ਮੈਂ ਮੰਨ ਕੇ ਚੱਲੀ ਹਾਂ ਤਾਂ ਫਿਰ ਹੁਣ ਚਾਹ ਦਾ ਵੀ ਫਿਰ ਲਾਉਣਾ ਪਵੇਗਾ ਚਾਹ ਦਾ ਤੁਸੀਂ ਦੱਸੋ ਚਾਹ ਦਾ ਕਿੰਨਾ ਹੋਵੇਗਾ ਕਿਉਂਕਿ ਮੈਂ ਆਪਦੇ ਹਿਸਾਬ ਨਾਲ ਸੋਚਿਆ ਸੀ ਵੀ ਇੱਕ ਪਲੇਟ ਜਿਹੜੀ ਹੋ ਗਈ ਉਹਦੇ ਵਿੱਚ ਜਿਵੇਂ ਇੱਕ ਵੜਾ ਪਾਓ ਹੋ ਗਿਆ ਜਾਂ ਫਿਰ ਬਿਸਕਿਟ ਹੋ ਜਾਣਗੇ ਨਾਲ ਇਹਦੇ ਨਾਲ ਇੱਕ ਚਾਹ ਹੋ ਜਾਏਗੀ ਵੀ ਇੰਨੀ ਕੁ ਆਈਟਮਸ ਹੋਣ ਅਤੇ ਫਿਰ ਜੇ ਚਾਲ੍ਹੀ ਰੁਪਏ ਦਾ ਲਗਾਉਂਗੇ ਤਾਂ ਉਹਦੇ ਹਿਸਾਬ ਨਾਲ ਤਾਂ ਫਿਰ ਪੜਤ ਮੈਨੂੰ ਪੈਣੀ ਨਹੀਂ ਗੀ ਠੀਕ

ਠੀਕ ਹੈ ਇਲਾਇਚੀ ਇਲਾਇਚੀ ਵਾਲੇ ਦਾ ਰੇ ਇਲਾਇਚੀ ਵਾਲੇ ਦਾ ਰੇਟ ਕੀ ਹੋਏਗਾ ਠੀਕ ਹੈ ਠੀਕ ਹੈ ਉਸ ਹਿਸਾਬ ਨਾਲ ਠੀਕ ਹੈ ਵੀ ਪੈਂਤੀ ਰੁਪਏ ਦਾ ਇੱਕ ਵੜਾ ਪਾਓ ਹੋ ਗਿਆ ਚਲੋ ਅਤੇ ਪੰਦਰ੍ਹਾਂ ਰੁਪਏ ਦੀ ਇੱਕ ਚਾਹ ਹੋ ਗਈ ਇਲਾਇਚੀ ਵਾਲੀ ਉਸ ਹਿਸਾਬ ਨਾਲ ਪੰਜਾਹ ਰੁਪਏ ਹੋ ਗਏ ਫਿਰ ਨਾਲ ਤੁਸੀਂ ਫਿਰ ਬਿਸਕੁਟ ਬਿਸਕੁਟ ਕਰ ਦਿਉ ਜਿਵੇਂ ਤੁਸੀਂ ਕਹਿੰਦੇ ਸੀ ਨਾ ਮਤਲਬ ਬਰਾਉਨ ਸ਼ੂਗਰ ਵਾਲੇ ਹਾਂਜੀ ਅਤੇ ਅਤੇ ਹਾਂਜੀ ਅਤੇ ਚਾਲ੍ਹੀ ਜਣਿਆਂ ਦਾ ਇਹ ਕਰਨਾ ਹੈ ਵੀ ਚਾਲੀ ਜਣਿਆਂ ਦੀ ਗੈਦਰਿੰਗ ਲਈ ਹੈਗਾ ਠੀਕ ਹੈ ਠੀਕ ਹੈ ਵੈਸੇ ਇਹ ਇਹ ਜਿਵੇਂ ਅੱਜ ਛੱਬੀ ਤਰੀਕ ਹੈ ਤਾਂ ਮੈਨੂੰ ਇਹ ਗੈਦਰਿੰਗ ਮੇਰੀ ਹੈਗੀ ਕੱਲ੍ਹ ਕੱਲ੍ਹ ਸ਼ਾਮੀ ਪੰਜ ਵਜੇ ਦੀ ਹੈ ਤਾਂ ਫਿਰ ਪੰਜ ਵਜੇ ਤੱਕ ਹੋ ਜਾਏਗਾ ਤੁਹਾਡਾ ਆਰਡਰ ਓਕੇ ਥੈਂਕ ਯੂ ਥੈਂਕ ਯੂ ਓਕੇ ਓਕੇ